ਮੈਂ ਜ਼ਿਆਦਾਤਰ ਆਪਣੇ ਰਣਜੀਤ ਐਵਨਿਊ ਦੇ ਵਿੱਚ ਰਾਣੀ ਕਾ ਬਾਗ ਵਿਖੇ ਮਾਤਾ ਲਾਲ ਦੇਵੀ ਜੀ ਦਾ ਮੰਦਰ ਜੋ ਕਿ ਬਹੁਤ ਹੀ ਧਾਰਮਿਕ ਸਥਾਨ ਹੈ ਉੱਥੇ ਆਪਣੀ ਅਕਸਰ ਪਰਿਵਾਰ ਦੇ ਨਾਲ ਜਾਂਦੀ ਰਹਿੰਦੀ ਹਾਂ ਉੱਥੇ ਮਾਤਾ ਲਾਲ ਦੇਵੀ ਜੀ ਦੀ ਮੂਰਤੀ ਸਥ ਸਥਾਪਿਤ ਹੈ ਅਤੇ ਉਸ 'ਤੇ ਪੌੜੀਆਂ ਚੜ ਕੇ ਉੱਪਰ ਜਾਈਏ ਤਾਂ ਉੱਥੇ ਵੈਸ਼ਨੋ ਦੇਵੀ ਮਾਤਾ ਜੀ ਦਾ ਵੀ ਗੁਫਾ ਲੰਘਦੀ ਹੈ ਜਿੱਥੇ ਜਾਣ ਦਾ ਬਹੁਤ ਹੀ ਜ਼ਿਆਦਾ ਸਵਾਦ ਅਤੇ ਅਨੰਦ ਆਉਂਦਾ ਹੈ ਉੱਥੇ ਜਾ ਕੇ ਇੱਕ ਮਨ ਨੂੰ ਬਹੁਤ ਹੀ ਸ਼ਾਂਤੀ ਹੁੰਦੀ ਹੈ ਜਦੋਂ ਕਦੀ ਵੀ ਅਸੀਂ ਆਪਣੇ ਰੋਜ਼ ਰੋਜ਼ਾਨਾ ਜ਼ਿੰਦਗੀ ਤੋਂ ਥੋੜ੍ਹਾ ਜਿਹਾ ਬਰੇਕ ਲੈਣ ਵਾਸਤੇ ਮੈਂ ਉੱਥੇ ਮੰਦਰ ਜਾਂਦੀ ਹਾਂ ਅਤੇ ਅਨੰਦ ਦੀ ਪ੍ਰਾਪਤੀ ਕਰਦੀ ਹਾਂ